ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਾ ਕਰਨਦੀਪ ਬੋਲਦਾ ਪਿਆ ਮੇਰੀ ਨਾ ਕੱਲ੍ਹ ਰਾਤ ਦੀ ਫਲਾਈਟ ਹੈਗੀ ਆ ਅਤੇ ਮੈਂ ਤੁਹਾਨੂੰ ਬੁੱਕ ਕਰਨਾ ਸੀ ਓਲਾ ਤੋਂ ਬੋਲਦੇ ਪਏ ਨਾ ਅਤੇ ਇੱਥੋਂ ਆਪਾਂ ਜਾਣਾ ਜੇ ਇਹ ਏਅਰਪੋਰਟ 'ਤੇ ਜਾਣਾ ਅਤੇ ਕਿੰਨੇ ਪੈਸੇ ਲਉਗੇ ਹਜ਼ਾਰ ਰੁਪਈਆ ਤਾਂ ਭਾਅ ਜੀ ਜਿ ਜ਼ਿਆਦਾ ਹੈਗਾ ਜੇ ਕੋਈ ਮਾਨ ਤਾਨ ਕਰੋ ਧੁੰਦ ਧੁੰਦ ਹੈਗੀ ਤਾਂ ਕਰਕੇ ਠੰਡ ਕਰਕੇ ਮੈਂ ਕਿਹਾ ਚਲੋ ਗੱਡੀ ਕਰ ਲਈਏ ਕਿ ਸਿੱਧਾ ਉੱਥੇ ਪਹੁੰਚ ਜਾਵਾਂਗੇ ਲੇਟ ਨਾ ਹੋਏ ਕੰਮ ਮੇਰੀ ਫਲਾਈਟ ਨਿਕਲ ਜਾਵੇਗੀ

ਚਲੋ ਜੋ ਮਾਨ ਤਾਨ ਹੈਗਾ ਅੱਠ ਸੌ ਰੁਪਈਆ ਕਰ ਲਉ ਮੈਂ ਤੁਹਾਨੂੰ ਬਹੁਤਾ ਕਿਹਾ ਹੀ ਨਹੀਂ ਅਤੇ ਮੈਂ ਫਿਰ ਤੁਹਾਨੂੰ ਫੋਨ ਕਰ ਦੂਗਾ ਅਤੇ ਆਪਾਂ ਅੱਧਾ ਕੁ ਘੰਟਾ ਪਹਿਲਾਂ ਫਿਰ ਤੁਸੀਂ ਵੀ ਉੱਠ ਜਿਓ ਨਾ ਕਿਉਂਕਿ ਟਾਈਮ ਸਿਰ ਪ ਪਹੁੰਚਣਾ ਧੁੰਦ ਧੰਦ ਤੁਹਾਨੂੰ ਪਤਾ ਰਸਤੇ ਵਿੱਚ ਬਹੁਤ ਹੁੰਦੀ ਫਰੈਸ਼ ਫਰੂਸ਼ ਹੋ ਕੇ ਫਿਰ ਤੁਸੀਂ ਇੱਧਰ ਮੇਰੇ ਵੱਲ ਆ ਜਿਓ ਅਤੇ ਆਪਾਂ ਇਕੱਠੇ ਚੱਲ ਪਵਾਂਗੇ ਹੈ ਨਾ ਅਤੇ ਮੈਂ ਤੁਹਾਨੂੰ ਫਿਰ ਫੋਨ ਕਰ ਦੂਗਾ ਸਵੇਰੇ ਅਤੇ ਅੱਧਾ ਘੰਟਾ ਪਹਿਲਾਂ ਅਤੇ ਫਿਰ ਆਪਾਂ ਨਿਕਲਣਾ ਜੀ ਟਾਈਮ ਸਿਰ ਮੇਰੀ ਫਲਾਈਟ ਨਾ ਨਿਕਲ ਜਾਵੇ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਤਾਂ ਉੱਥੇ ਪੇਮੈਂਟ ਤੁਹਾਨੂੰ ਔਨਲਾਈਨ ਕਹੁੰਗੇ ਔਨਲਾਈਨ ਕਰ ਦਿੰਦਾ ਹੁਣੇ ਕਰ ਦਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਆ ਜਾਇਉ ਟਾਈਮ ਸਿਰ ਮੈਂ ਲੇਟ ਨਾ ਹੋ ਜਾਵੇ ਮੇਰੀ ਫਲਾਈਟ ਹੈਗੀ ਹੈ ਠੀਕ ਹੈ ਜੀ ਸਾ ਹਾਂਜੀ ਹਾਂਜੀ ਹਾਂਜੀ ਦਿ ਦਿੱਲੀ ਏਅਰਪੋਰਟ 'ਤੇ ਹਾਂਜੀ ਇੱਥੋਂ ਚਲੋ ਠੀਕ ਆ ਭਾਅ ਜੀ ਸਤਿ ਸ਼੍ਰੀ ਅਕਾਲ